ਮੈਂ ਰਜੇਸ਼ ਕੁਮਾਰ ਵਾਸੀ ਫਿਰੋਜ਼ਪੁਰ ਕਲਾਂ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੇਰੀ ਮਨ ਪਸੰਦ ਪੁਸਤਕ ਹੈ ਮੇਰਾ ਪੰਜਾਬੀ ਐੱਮ ਫਿਲ ਦਾ ਥੀਸਜ਼ ਜਿਹੜਾ ਕਿ ਕਾਦਰਯਾਰ ਦਾ ਪੂਰਨ ਭਗਤ ਅਤੇ ਰਾਮ ਧਨ ਜੰਮੂ ਕਸ਼ਮੀਰ ਦੇ ਕਵੀ ਦਾ ਪੂਰਨ ਭਗਤ ਦੋਨਾਂ ਦਾ ਤੁਲਨਾਤਮਕ ਅਧਿਐਨ ਉਸ ਵਿੱਚ ਮੈਂ ਇਹ ਦੇਖਿਆ ਹੈ ਕਿ ਉਹਦੇ ਵਿੱਚ ਕਵੀ ਨੇ ਵੱਖਰੇ ਵੱਖਰੀ ਸ਼ਹਰਫੀ ਕਾਵਿ ਰੂਪ ਦੇ ਨਾਲ ਇਸ ਕਿੱਸੇ ਨੂੰ ਸ਼ੁਰੂ ਕਰਕੇ ਆਪਣੀ ਕਾਰਗੁਜ਼ਾਰੀ ਕੀਤੀ ਹੈ ਜਿਹੜਾ ਰਾ ਕਾਦਰਯਾਰ ਹੈ ਉਸਨੇ ਇਸ ਇੱਸੇ ਨੂੰ ਪੰਜ ਸ਼ਹਿਰਫੀਆਂ ਵਿੱਚ ਲਿਖਿਆ ਅਤੇ ਕਾਦਰਯਾਰ ਰਾਮਧਨ ਨੇ ਇਸ ਕਿੱਸੇ ਨੂੰ ਸੱਤ ਸ਼ਹਿਰਫੀਆਂ ਵਿੱਚ ਲਿਖਿਆ ਸ਼ਹਿਰਫੀ ਉਰਦੂ ਦਾ ਕਾਵਿ ਅੱਖਰ ਹੈ ਜਿਸ ਤਰ੍ਹਾਂ ਅਲਫ ਆਖ ਸਖੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਦੇ ਜਾਇਆ ਈ ਜਿੱਦਾਂ ਵੇ ਵੇ ਵੇ ਉੱਤੇ ਜਿਵੇਂ ਲਿਖਿਆ ਸੀ ਤੇ ਮੈਂ ਪੰਗਤਾ ਆਖ ਸੁਣਾਏ ਦਿੱਤਾ ਕ ਪੂਰਨ ਇੱਕ ਭੋਰ ਨੂੰ ਕੱਢ ਕੇ ਤੇ ਦੂਸਰੀ ਕੋਠੜੀ ਵਿੱਚ ਪਾਏ ਦਿੱਤਾ ਧੰਨਵਾਦ